ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਹੁਤ ਹੀ ਜ਼ਿਆਦਾ ਬਾਇਓਗੈਸ ਪਲਾਂਟ ਦੇਖੇ ਹਨ ਅਤੇ ਸਾਡੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਬਾਇਓਗੈਸ ਪਲਾਂਟ ਹੈ ਅਤੇ ਅਸੀਂ ਵੀ ਬਾਇਓਗੈਸ ਪਲਾਂਟ ਦਾ ਯੂਸ ਕਰਦੇ ਹਨ ਜਿਹਦਾ ਸਾਨੂੰ ਬਹੁਤ ਹੀ ਫਾਇਦਾ ਹੈ ਇਸ ਦੇ ਵਿੱਚ ਸਾਨੂੰ ਬਾਹਰੋਂ ਗੈਸ ਲੈਣ ਦੀ ਜ਼ਰੂਰਤ ਨਹੀਂ ਹਨ ਅਸੀ ਇਸਦੀ ਹੈਲਪ ਅਸੀਂ ਇਸਦੇ ਸਾਨੂੰ ਸਿਲੰਡਰ ਦੇ ਜਿਹੜੇ ਪੈਸੇ ਹੈ ਉਹ ਬ ਬ ਬ ਬਚ ਜਾਂਦੇ ਹਨ ਅਸੀਂ ਇਸ ਦੇ ਬਾਇਓਗੈਸ ਦੀ ਪਲਾਂਟ ਨਾਲ਼ ਅਸੀਂ ਪੈਸੇ ਆਪਣੀ ਗੈਸ ਯੂਸ ਕਰਦੇ ਹਨ